ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦੀ ਹਾਂ ਸਿੱਖ ਧਰਮ ਮੈਂ ਕਿਸੇ ਵੀ ਮਤਲਬ ਹਿੰਦੂ ਧਰਮ ਜਾਂ ਈਸਾਈ ਵਿੱਚ ਕਦੇ ਵੀ ਫਰਕ ਨਹੀਂ ਕਰਦੀ ਮੈਂ ਹਰੇਕ ਹੀ ਧਰਮ ਦਾ ਸਤਿਕਾਰ ਕਰਦੀ ਹਾਂ ਸਿੱਖ ਧਰਮ ਵਿੱਚ ਸਿੱਖ ਧਰਮ ਵਿੱਚ ਬਹੁਤ ਸਾਰੇ ਐਸੇ ਤਿਉਹਾਰ ਹਨ ਜੋ ਵਧੀਆ ਢੰਗ ਨਾਲ ਮਨਾਏ ਜਾਂਦੇ ਹਨ ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮਦਿਨ ਲੋਕ ਉਸ ਦਿਨ ਅਖੰਡ ਪਾਠ ਰੱਖਦੇ ਹਨ ਅਤੇ ਤਿੰਨ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਤੀਸਰੇ ਤਿੰਨ ਉਹਨਾਂ ਤੀਸਰੇ ਦਿਨ ਉਹ ਅਖੰਡ ਪਾਠ ਦਾ ਭੋਗ ਪਾਇਆ ਜਾਂਦਾ ਹੈ ਅਤੇ ਇਵੇਂ ਹੀ ਗੁਰੂ ਰਵਿ ਰਵਿਦਾਸ ਮਹਾਰਾਜ ਜੀ ਦਾ ਜਨਮਦਿਨ ਮਨਾਇਆ ਜਾਂਦਾ ਹੈ ਜਿਸ ਵਿੱਚ ਤਿੰਨ ਦਿਨਾਂ ਬਾਅਦ ਹੀ ਤੀਸਰੇ ਦਿਨ ਹੀ ਅਖੰਡ ਪਾਠ ਦੀ ਸਥਾਪਨਾ ਕੀਤ ਅਖੰਡ ਪਾਠ ਨੂੰ ਸਮਾਪਤ ਕੀਤਾ ਜਾਂਦਾ ਹੈ ਇਸ ਤਰ੍ਹਾਂ ਹੀ ਜਿਵੇਂ ਦ ਇਸ ਤਰ੍ਹਾਂ ਹੀ ਜਿਵੇਂ ਦੁਸਹਿਰੇ ਦਾ ਤਿਉਹਾਰ ਜਿਵੇਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਦਿਨ ਸ਼੍ਰੀ ਗੁਰੂ ਇਸ ਦਿਨ ਸ਼੍ਰੀ ਰਾਵਣ ਚੌਦ੍ਹਾਂ ਸਾਲਾਂ ਦਾ ਬਣਵਾਸ ਕੱਟ ਕੇ ਘਰ ਨੂੰ ਪਰਤੇ ਸਨ ਜਿਸ ਕਰਕੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਸਿੱਖ ਧਰਮ ਵਿੱਚ ਬਹੁਤ ਹੀ ਸਿੱਖ ਧਰਮ ਵਿੱਚ ਬਹੁਤ ਲੋਕ ਸਿੱਖ ਧਰਮ ਨੂੰ ਬਹੁਤ ਹੀ ਵਧੀਆ ਢੰਗ ਨਾਲ ਮੰਨਦੇ ਹਨ ਅਤੇ ਬਹੁਤ ਲੋਕ ਆਪਣੇ ਘਰਾਂ ਵਿੱਚ ਪਾਠ ਕਰਦੇ ਹਨ ਸ ਅਤੇ ਆਪਣੇ ਘਰਾਂ ਵਿੱਚ ਪਾਠ ਕਰਦੇ ਹਨ ਅਤੇ ਮਹਾਰਾਜ ਨੂੰ ਆਪਣੇ ਘਰ ਵਿੱਚ ਲਿਆਉਂਦੇ ਹਨ